ਹਾਂਜੀ ਗੁੱਡ ਆਫਟਰਨੂਨ ਮੈਮ ਮੈਮ ਮੈਂ ਤੁਹਾਨੂੰ ਕੁਛ ਹਾਂਜੀ ਯੈਸ ਮੈਮ ਐਕਚੁਲੀ ਨਾ ਮੈਂ ਨਾ ਬਾਹਰ ਐ ਅਤੇ ਮੈਨੂੰ ਨਾ ਥੋੜ੍ਹਾ ਕੋਲਡ ਹੋ ਰਿਹਾ ਆ ਅਤੇ ਮੈਨੂੰ ਤੁਸੀਂ ਮੈਡੀਸਿਨ ਦੱਸੋ ਮੈਂ ਕੀ ਕਰਾਂ ਹੈ ਨਹੀਂ ਜੀ ਮੈਂ ਤੁਹਾਡੇ ਕੋਲੋਂ ਹੀ ਮੈ ਮੈਡੀਸਿਨ ਲੈਂਦੀ ਹਾਂ ਇਸ ਕਰਕੇ ਮੈਂ ਦੂਸਰੀ ਮੈਡੀਸਿਨ ਨਹੀਂ ਲਿਆਉਂਦੀ ਹਾਂਜੀ ਮੇਰਾ ਨਾਮ ਸੁਨੀਲ ਲਤਾ ਹੈ ਮੈਂ ਨਾ ਵਿਆਹ 'ਤੇ ਗਈ ਸੀ ਹਾਂ ਉੱਥੇ ਮੈਨੂੰ ਥੋੜ੍ਹਾ ਹਾਂਜੀ ਗਲਾ ਵੀ ਦਰਦ ਹੈ ਨਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਮੈਮ ਹਾਂਜੀ ਹਾਂਜੀ ਮੈਡੀਸਿਨ ਫਿਲਹਾਲ ਮੈਂ ਮੈਡੀਕਲ ਸ਼ੋਪ ਤੋਂ ਲੈ ਲਈ ਹੈ ਅਤੇ ਇੱਕ ਮੈਂ ਉਹਨੇ ਕੋਲਡ ਦੀ ਦਿੱਤੀ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂ ਠੀਕ ਆ ਮੈਡਮ

ਠੀਕ ਹੈ ਮੈਮ ਮੈਮ ਹਾਂਜੀ ਹਾਂਜੀ ਤੁਹਾਡੇ ਨਾਲ ਵੈਸੇ ਵੀ ਗੱਲ ਕਰਕੇ ਥੋੜ੍ਹਾ ਮੈਮ ਤੁਸੀਂ ਮੇਰੇ ਸ਼ੁਰੂ ਤੋਂ ਹੀ ਹੈਗੇ ਆਂ ਫੈਮਲੀ ਡੋਕਟਰ ਆ ਤੁਸੀਂ ਇਸ ਕਰਕੇ ਮੈਂ ਤੁਹਾਡੇ 'ਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਠੀਕ ਮੈਮ ਥੈਂਕ ਯੂ ਮੈਮ